ਅੰਮ੍ਰਿਤਸਰ ਸ਼ਹਿਰ ਇੱਕ ਬਹੁਤ ਹੀ ਆਵਾਜਾਈ ਵਾਲਾ ਸ਼ਹਿਰ ਹੈ ਜਿੱਥੇ ਕਿ ਹਰ ਟਾਈਮ ਲੋਕ ਕੁਛ ਨਾ ਕੁਛ ਕਰਨ ਲਈ ਇੱਧਰ ਉੱਧਰ ਜਾਂਦੇ ਰਹਿੰਦੇ ਹਨ ਇਸ ਲਈ ਇਹ ਸਾਡੇ ਇਸ ਚੀਜ਼ ਨੂੰ ਸੌਖਾ ਕਰਨ ਲਈ ਇੱਥੇ ਅੋਟੋ ਕੈਬਸ ਬੱਸਿਸ ਆਦਿ ਸਭ ਕੁਛ ਇੱਥੇ ਉਹ ਉਪਲੱਬਧ ਹੈ ਅੋਟੋ ਰਿਕਸ਼ੇ ਵਗੈਰਾ ਸਾਡੇ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦੇ ਹਨ ਜਦੋਂ ਵੀ ਸਾਨੂੰ ਕਿਤੇ ਜ਼ਰੂਰੀ ਜਾਣਾ ਹੁੰਦਾ ਹੈ ਤਾਂ ਅਸੀਂ ਕੋਈ ਕੈਬ ਬੁੱਕ ਕਰਵਾ ਲੈਂਦੇ ਹਾਂ ਤਾਂ ਉਹ ਸਾਨੂੰ ਉਸੇ ਟਾਈਮ ਆ ਕੇ ਉੱਥੋਂ ਲੈ ਜਾਂਦੀ ਹੈ ਜਿੱਥੇ ਅਸੀਂ ਜਾਣਾ ਹੁੰਦਾ ਹੈ ਉਹ ਸਾਨੂੰ ਸਮੇਂ ਸਿਰ ਪਹੁੰਚਾ ਦਿੰਦੀ ਹੈ ਤਾਂ ਸਾਡੇ ਟਾਈਮ ਦੀ ਵੀ ਬੱਚਤ ਹੁੰਦੀ ਹੈ ਬੱਸਾਂ ਵੀ ਸਾਡੇ ਲਈ ਹਰ ਟਾਈਮ ਉਪਲੱਬਧ ਹੁੰਦੀਆਂ ਹਨ ਇੱਕ ਬੱਸ ਤੋਂ ਬਾਅਦ ਦੂਜੀ ਬੱਸ ਨਾਲ ਹੀ ਲੱਗ ਜਾਂਦੀ ਹੈ ਜੋ ਕਿ ਸਾਰੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ ਜਿੱਥੇ ਵੀ ਅਸੀਂ ਜਾਣਾ ਹੋਵੇ ਤਾਂ ਅਸੀਂ ਬੜੇ ਆਰਾਮ ਨਾਲ ਜਾ ਸਕਦੇ ਹਾਂ ਬੱਸਾਂ ਕਾਰਾਂ ਟਰੇਨਾਂ ਸਭ ਹੀ ਲੋਕਲ ਸਰਵਿਸ ਵਾਲੀਆਂ ਚੀਜ਼ਾਂ ਜੋ ਕਿ ਸਾਡੀ ਬਹੁਤ ਹੀ ਮਦਦ ਕਰਦੀਆਂ ਹਨ ਕਿਸੇ ਵੀ ਥਾਂ 'ਤੇ ਪਹੁੰਚਣ ਲਈ ਲੋਕਲ ਬੱਸਿਸ ਦਾ ਆਪਣਾ ਫਿਕਸ ਟਾਈਮ ਹੁੰਦਾ ਹੈ ਜੋ ਕਿ ਆਪਣੇ ਸਮੇਂ 'ਤੇ ਆ ਜਾਂਦੀਆਂ ਹਨ ਅਤੇ ਅਸੀਂ ਉਹਨਾਂ ਵਿੱਚ ਜਾ ਸਕਦੇ ਹਾਂ ਧੰਨਵਾਦ